ਔਨਲਾਈਨ ਸ਼ੋਪਿੰਗ ਅੱਜ ਕੱਲ੍ਹ ਦੇ ਜ਼ਮਾਨੇ ਦੀ ਸਭ ਤੋਂ ਵੱਡਾ ਪਲੇਟਫਾਰਮ ਹੈ ਜਿੱਥੇ ਕਿ ਟਾਈਮ ਦੀ ਬੱਚਤ ਹੁੰਦੀ ਹੈ

ਕਦੇ ਕਦੇ ਪੈਸੇ ਦੀ ਵੀ ਬੱਚਤ ਹੁੰਦੀ ਮੈਂ ਐਮਾਜੋਨ ਫਲਿਪ ਕਾਰਡ ਈ ਬੇ ਇਹ ਸਾਰੀਆਂ ਜਿਹੜੀਆਂ ਸ਼ੋਪਿੰਗ ਵਾਲੀਆਂ ਜਗ੍ਹਾ ਤੋਂ ਸ਼ੋਪਿੰਗ ਕੀਤੀ ਹੈ ਕਰ ਚੁਕਿਆ ਕੁਛ ਸ਼ੋਪਿੰਗ ਸਾਈਟਾਂ ਦਾ ਬੜਾ ਵਧੀਆ ਐਕਪੀਰੀਅੰਸ ਰਿਹਾ ਕੁਛ ਦਾ ਬਹੁਤ ਜ਼ਿਆਦਾ ਮਾੜਾ ਬਜ਼ਾਰਾਂ ਦੀ ਸਥਿਤੀ ਇਹਨਾਂ ਨੇ ਇਸ ਕਰਕੇ ਬਦਲ ਦਿੱਤੀ ਕਿ ਆਪਾਂ ਨੂੰ ਕੋਈ ਵੀ ਚੀਜ਼ ਲੈਣੀ ਹੋਵੇ ਆਪਾਂ ਨੂੰ ਉਸ ਦਾ ਪਹਿਲਾਂ ਔਨਲਾਈਨ ਪ੍ਰਾਸ ਪ੍ਰਾਈਜ਼ ਪਤਾ ਲੱਗ ਜਾਂਦਾ ਫਿਰ ਅਸੀਂ ਬਾਰਗੇਨਿੰਗ ਕਰ ਸਕਦੇ ਹਾਂ ਤੋੜ ਮਰੋੜ ਸਕਦੇ ਜਿਹੜਾ ਭਾਅ ਹੁੰਦਾ ਕਿਸੇ ਵੀ ਚੀਜ਼ ਦਾ ਜ਼ਿਆਦਾ ਲੁੱਟ ਤੋਂ ਬਚਿਆ ਜਾ ਸਕਦਾ ਕੁਛ ਕੁ ਚੰਗੀਆਂ ਚੀਜ਼ਾਂ ਇਹ ਵੀ ਬਸ ਇਹੀ ਜਿਵੇਂ ਆਪਾਂ ਕਹਿ ਰਹੇ ਆ ਵੀ ਕੁਛ ਬਚਿਆ ਜਾ ਸਕਦਾ ਕੁਛ ਲੁੱਟ ਖਸੁੱਟ ਤੋਂ ਜ਼ਿਆਦਾ ਪੈਸੇ ਨਹੀਂ ਲਗਾ ਸਕਦਾ ਕੋਈ ਕਸਟਮਰ ਨੂੰ ਪਰ ਇਹਦੀਆਂ ਹਾਨੀਆਂ ਵੀ ਹੈਗੀਆਂ ਜ਼ਿਆਦਾ ਔਨਲਾਈਨ ਦੇ ਚੱਕਰ ਦੇ ਵਿੱਚ ਆਪਾਂ ਕਈ ਵਾਰੀ ਨੁਕਸਾਨ ਕਰ ਬੈਠਦੇ ਹਾਂ ਚੀਜ਼ ਨਹੀਂ ਵੀ ਖਰੀਦਣੀ ਹੁੰਦੀ ਵੈਸੇ ਹੀ ਖਰੀਦੀ ਜਾਂਦੀ ਹੈ ਜਾਂ ਆਪਾਂ ਨੂੰ ਇਹ ਲੱਗਦਾ ਵੀ ਆਪਾਂ ਖਰੀਦ ਸਕਦੇ ਹਾਂ ਪੈਸੇ ਦੀ ਵੇਸਟੇਜ ਬਹੁਤ ਜ਼ਿਆਦਾ ਹੁੰਦੀ ਆ ਔਨਲਾਈਨ ਸ਼ੋਪਿੰਗ ਦੇ ਨਾਲ ਬਸ ਆਹੀ ਦੋ ਚਾਰ ਗੱਲਾਂ ਹੁੰਦੀਆਂ